ਬਾਈਕਿੰਗ ਕਮਿਊਨਿਟੀ ਵਿੱਚ ਸ਼ਾਮਿਲ ਹੋਣ ਵਾਸਤੇ ਇਸ ਦੇ ਨਾਲ ਜੋ ਜੋ ਲੰਮੇ ਟੂਰ ਦੀ ਯਾਤਰਾ ਹੈ ਉਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਹੁੰਦੀ ਹੈ ਮੈਨੂੰ ਬਾਈਕਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਹੋਰ ਕਿਸੇ ਸਾਧਨ ਵਿੱਚ ਸਫਰ ਕਰਨਾ ਮੇਰੇ ਵਾਸਤੇ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਇਸ ਕਰਕੇ ਮੈਂ ਬਾਈਕਿੰਗ ਨੂੰ ਬਹੁਤ ਜ਼ਿਆਦਾ ਪਹਿਲ ਦਿੰਦਾ ਹਾਂ ਜਦੋਂ ਵੀ ਮੈਂ ਕਿਤੇ ਜਾਂਦਾ ਹਾਂ ਤਾਂ ਬਾਈਕ ਉੱਪਰ ਚੜ੍ਹ ਕੇ ਹੀ ਆਪਣੇ ਸਫਰ ਨੂੰ ਤੈਅ ਕਰਦਾ ਹਾਂ ਮੈਨੂੰ ਘੁੰਮਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਅਤੇ ਇਸ ਦੇ ਨਾਲ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਹਾਂ ਬਾਈਕਿੰਗ ਕਮਿਊਨਿਟੀ ਦੇ ਨਾਲ ਸ਼ਾਮਲ ਹੋਣ ਦੇ ਨਾਲ ਮੈਂ ਵੱਖਰੇ ਵੱਖਰੇ ਟੂਰ ਉੱਪਰ ਜਾਂਦਾ ਹਾਂ ਜੋ ਬਹੁਤ ਹੀ ਦੂਰ ਦੂਰ ਤੱਕ ਹਨ ਅਤੇ ਇਹਨਾਂ ਦੇ ਨਾਲ ਰਸਤੇ ਵਿੱਚ ਆਪਣੀ ਮਰਜ਼ੀ ਦੇ ਅਨੁਸਾਰ ਮੈਂ ਜਿੱਥੇ ਮੇਰਾ ਮਨ ਕਰੇ ਜਿੱਥੇ ਮੈਨੂੰ ਵਧੀਆ ਦ੍ਰਿਸ਼ ਲੱਗਣ ਉੱਥੇ ਮੈਂ ਰੁਕਦਾ ਹਾਂ ਅਤੇ ਵੱਖਰੇ ਵੱਖਰੇ ਲੋਕਾਂ ਦੇ ਨਾਲ ਵੀ ਮਿਲਦਾ ਹਾਂ ਅਤੇ ਇਸ ਕ ਇਸੇ ਇਹਨਾਂ ਵਜ੍ਹਾ ਕਰਕੇ ਮੈਂ ਬਾਈਕਿੰਗ ਨੂੰ ਤਰਜੀਹ ਦਿੰਦਾ ਹਾਂ ਅਤੇ ਆਪਣੀ ਮਰਜ਼ੀ ਦੇ ਨਾਲ ਆਪਣੀ ਚਾਲ ਚੱਲਦਾ ਹਾਂ ਬਾਈਕਿੰਗ ਦਾ ਇਸ ਕਰਕੇ ਮੈਨੂੰ ਜ਼ਿਆਦਾ ਸ਼ੌਂਕ ਹੈ ਅਤੇ ਮੈਂ ਸਭ ਤੋਂ ਜ਼ਿਆਦਾ ਤਰਜੀਹ ਬਾਈਕਿੰਗ ਨੂੰ ਹੀ ਦਿੰਦਾ ਹਾਂ ਉਸ ਤੋਂ ਬਾਅਦ ਹੋਰ ਕਿਸੇ ਵਹੀਕਲ ਸਾਧਨ ਨੂੰ ਮੈਂ ਤਰਜੀਹ ਦਿੰਦਾ